ਹੈਲੋ ਹਾਂਜੀ ਏਕਤਾ ਸਤਿ ਸ਼੍ਰੀ ਅਕਾਲ ਬਸ ਵਧੀਆ ਤੁਸੀਂ ਸੁਣਾਓ ਬਸ ਕੁਛ ਨੀ ਘਰੇ ਫਰੀ ਹੋਈਦਾ ਹੁਣ

ਹਾਂਜੀ ਹਾਂਜੀ ਅਜੇ ਹਾਂਜੀ ਹੁਣ ਤਾਂ ਵੈਸੇ ਐਡਮਿਸ਼ਨ ਚੱਲ ਰਹੀਆਂ ਨੇ ਹੁਣ ਅਤੇ ਮਤਲਬ ਬੱਚਿਆਂ ਦੇ ਉਹ ਕੰਪੀਟੀਸ਼ਨ ਵਗੈਰਾ ਵੀ ਹੋ ਰਹੇ ਆ ਕਈ ਕਰਵਾ ਰਹੇ ਆ ਜਿੱਦਾਂ ਗੇਮ ਕਰਵਾ ਰਹੇ ਹੈ ਆਰਟ ਕੋਂਪੀਟੀਸ਼ਨ ਕਰਵਾ ਰਹੇ ਆ ਹੈ ਨਾ ਅਤੇ ਆਪਾਂ ਹੁਣ ਦੇਖ ਲੈਂਦੇ ਹਾਂ ਜਿਵੇਂ ਆਨੰਦ ਪਬਲਿਕ ਵੀ ਹੋਇਆ ਸੀਗਾ ਗੇਮਸ ਦਾ ਕੋਂਪੀਟੀਸ਼ਨ

ਹਾਂਜੀ ਹਾਂਜੀ ਹਾਂਜੀ ਇਵੇਂ ਦਾ ਇੱਕ ਪੈਂਫਲੇਟ ਨਾ ਕੱਲ੍ਹ ਆਇਆ ਸੀ ਨਿਊਜ਼ ਪੇਪਰ ਦੇ ਵਿੱਚ ਮਤਲਬ ਅਤੇ ਉਹ ਹੈ ਅਤੇ ਸਕੂਲ ਸਿਟੀ ਤੋਂ ਬਾਹਰ ਹੀ ਹੈ ਗੁਰੂ ਅਮਰਦਾਸ ਪਬਲਿਕ ਸਕੂਲ ਅਤੇ ਮਤਲਬ ਉਹਨਾਂ ਦਾ ਫੀ ਮੈਂ ਕੋਲ ਕੀਤੀ ਸੀਗੀ ਜਿੱਦਾਂ ਉਹਨਾਂ ਨੂੰ ਅਤੇ ਫੀਸ ਸਟਰਕਚਰ ਵੀ ਉਹਨਾਂ ਦਾ ਬਹੁਤ ਵਧੀਆ ਸੀਗਾ ਬਾਕੀ ਫੈਸਿਲਿਟੀਜ਼ ਹੈਗੀਆਂ ਜਿਵੇਂ ਸਮਰ ਸੀਜਨ ਦੇ ਵਿੱਚ ਏ ਸੀ ਫੈਸਿਲਿਟੀ ਆ ਵਿੰਟਰ ਦੇ ਵਿੱਚ ਫੂਡ ਜਿੱਦਾਂ ਗਰਮ ਮਿਲਦਾ ਬੱਚਿਆਂ ਨੂੰ ਅਤੇ ਹਾਂ ਅਤੇ ਉਹਨਾਂ ਦਾ ਮਤਲਬ

ਹਾਂਜੀ ਹਾਂਜੀ ਹਾਂਜੀ ਹਾਂਜੀ ਨਾਲੇ ਮੇਰੀ ਇੱਕ ਫਰੈਂਡ ਵੀ ਟੀਚ ਕਰਦੀ ਹੈ ਮੈਂ ਉਹਨਾਂ ਕੋਲੋਂ ਮਤਲਬ ਸਾਰਾ ਇਨਫੋਰਮੇਸ਼ਨ ਥੋੜ੍ਹੀ ਅਤੇ ਲਈ ਥੋੜ੍ਹੀ ਹੋਰ ਲਵਾਂਗੀ ਉਹਨਾਂ ਨੂੰ ਪੁੱਛਾਂਗੀ ਸਾਰੀ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਸਕੂਲ ਦੇ ਬਾਰੇ ਦੇ ਵਿੱਚ ਕਿ ਕਿਵੇਂ ਇੰਨਾ ਮਤਲਬ ਉਹਨਾਂ ਦਾ ਕਰੀਕੁਲਮ ਕਿਵੇਂ ਦਾ ਆ ਐਕਟੀਵਿਟੀ ਕਿਵੇਂ ਦੀਆਂ ਵਾ ਹੈ ਨਾ ਅਤੇ ਆਪਾਂ ਨੂੰ ਥੋੜ੍ਹੀ ਨਾਲੇਜ ਹੋ ਜਾਏਗੀ ਉਹਨਾਂ ਦੇ ਬਾਰੇ

ਹਾਂਜੀ ਹਾਂਜੀ ਆਪਾਂ ਦੇਖਦੇ ਹਾਂ ਹਾਂਜੀ ਅਤੇ ਉਹ ਹੋਰ ਵੀ ਮੈਨੂੰ ਹਾਂਜੀ ਹਾਂਜੀ ਜ਼ਰੂਰ ਆਵਾਂਗੇ ਅਤੇ ਮੈਨੂੰ ਉਹ ਇੱਕ ਹੋਰ ਗੱਲ ਵੀ ਕਹਿ ਰਹੀ ਸੀ ਕਿ ਉਹ ਜਿਵੇਂ ਹੁਣ ਇਹ ਸਕੂਲ ਵਿਲੇਜ ਦੇ ਵਿੱਚ ਆ ਅਤੇ ਬੱਚੇ ਵੀ ਕਾਫੀ ਕਹਿੰਦੇ ਕਿ ਮਤਲਬ ਡਿਸਟਰਿਕਟ ਲੈਵਲ ਅਤੇ ਜਾ ਰਹੇ ਆ ਜ ਜ਼ਿਲ੍ਹਾ ਪੱਧਰੀ ਜਾ ਰਹੇ ਆ ਅਤੇ ਰਾਜ ਪੱਧਰ 'ਤੇ ਵੀ ਜਾ ਰਹੇ ਆ ਬੱਚੇ ਹੈ ਨਾ ਬਹੁਤ ਸਾਰੇ ਜਿੱਦਾਂ ਮੈਡਲਜ਼ ਪ੍ਰਾਈਜ਼ਿਜ ਜਿੱਤ ਕੇ ਆਉਂਦੇ ਆ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਚਲੋ ਕੋਈ ਨਹੀਂ ਆਪਾਂ ਇਸ ਇਸ ਐਤਵਾਰ ਮਿਲਦੇ ਆ ਠੀਕ ਹੈ ਜੀ ਓਕੇ ਜੀ ਬਾਏ ਬਾਏ